ਮੈਂ ਤੁਹਾਡੇ ਨਾਲ ਇੱਕ ਦੋਸਤ ਸੰਬੰਧੀ ਚੁਟਕਲਾ ਪੇਸ਼ ਕਰਨ ਜਾ ਰਿਹਾ ਹਾਂ ਇੱਕ ਮਜ਼ੇਦਾਰ ਚੁਟਕੁਲਾ ਇਹ ਹੈ ਕਿ ਇੱਕ ਆਦਮੀ ਆਪਣੇ ਦੋਸਤ ਨੂੰ ਕਹਿੰਦਾ ਯਾਰ ਮੈਂ ਸੋਚ ਰਿਹਾ ਕਿ ਮੇਰਾ ਕੁੱਤਾ ਬਹੁਤ ਬੁੱਧੀਮਾਨ ਹੈ ਦੋਸਤੋਂ ਨੇ ਪੁੱਛਿਆ ਕਿ ਕਿਵੇਂ ਆਦਮੀ ਕਹਿੰਦਾ ਜਦੋਂ ਵੀ ਮੈਂ ਕਹਿੰਦਾ ਹਾਂ ਚੱਲ ਬਾਹਰ ਚੱਲੀਏ ਉਹ ਫੱਟ ਦੇਣੇ ਗੇਟ ਵੱਲ ਚਲਿਆ ਜਾਂਦਾ ਹੈ ਸੱਚ ਮੁੱਚ ਕੁੱਤੇ ਵੀ ਬਹੁਤ ਕੁੱਤੇ ਵੀ ਸਾਨੂੰ ਸਮਝਦੇ ਹਨ ਦੂਜਾ ਚੁਟਕਲਾ ਇੱਕ ਮਾਸਟਰ ਜੀ ਪਿੰਡ ਦੇ ਬੱਚਿਆਂ ਨੂੰ ਸਿਖਾ ਰਹੇ ਸਨ ਉਹ ਕਹਿੰਦੇ ਜੇ ਤੁਸੀਂ ਇੱਕ ਬੱਦਲ 'ਤੇ ਚੜ੍ਹੇ ਹੋ ਤਾਂ ਕੀ ਕਰੋਗੇ ਇੱਕ ਬੱਚਾ ਕਹਿੰਦਾ ਮਾਸਟਰ ਜੀ ਮੈਂ ਪਹਿਲਾਂ ਹੀ ਇਨਕਾਰ ਕਰ ਦੇਵਾਂਗਾ ਸਭ ਬੱਚੇ ਹੱਸ ਪਏ ਕਿਉਂਕਿ ਉਹਨੂੰ ਜਾਣਦੇ ਸਨ ਕਿ ਬਦਲ 'ਤੇ ਚੜ੍ਹਨਾ ਕੋਈ ਆਸਾਨ ਗੱਲ ਨਹੀਂ ਇਹ ਦੋ ਚੁਟਕੁਲੇ ਬਹੁਤ ਹਾਸੀ ਮਜ਼ਾਕ ਵਾਲੇ ਹਨ ਜਦੋਂ ਵੀ ਮੇਰੇ ਇਹ ਚੁਟਕਲੇ ਮਨ ਵਿੱਚ ਆਉਂਦੇ ਹਨ ਮੈਂ ਬਹੁਤ ਹੱਸਦਾ ਹਾਂ ਅਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਚੁਟਕਲੇ ਸਾਂਝੇ ਕਰਦਾ ਹਾਂ ਇਹੀ ਚੁਟਕਲੇ ਮਨ ਨੂੰ ਬਹੁਤ ਭਾਉਂਦੇ ਹਨ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਹੱਸਦੇ ਹੈ ਅਤੇ ਜਦੋਂ ਵੀ ਸਕੂਲ ਵਿੱਚ ਜਾਂ ਫਰੈਂਡਸ ਇਕੱਠੇ ਹੁੰਦੇ ਹਨ ਮੈਂ ਉਹਨਾਂ ਨੂੰ ਇਹ ਚੁਟਕਲਾ ਸੁਣਾਉਂਦਾ ਹਾਂ ਅਤੇ ਉਹ ਬਹੁਤ ਖੁਸ਼ ਹੋ ਕੇ ਹੱਸਦੇ ਆ ਨਾ ਕਿ ਅਸੀਂ ਬਹੁਤ ਮਜੇ ਕਰਦੇ ਹਾਂ ਚੁਟਕਲੇ ਸੁਣਾ ਕੇ ਚੁਟਕੁਲੇ ਇੱਕ ਆਦਮੀ ਆਪਣੇ ਦੋਸਤ ਨੂੰ ਕਹਿੰਦਾ ਯਾਰ ਮੈਂ ਸੋਚ ਰਿਹਾ ਹਾਂ ਕਿ ਤੇਰਾ ਕੁੱਤਾ ਬਹੁਤ ਬੁੱਧੀਮਾਨ ਹੈ ਦੋਸਤ ਨੇ ਪੁੱਛਿਆ ਕਿਵੇ ਆਧੁਨਿਕ ਕਹਿੰਦਾ ਜਦੋਂ ਵੀ ਮੈਂ ਕਹਿੰਦਾ ਹਾਂ ਚਲ ਬਾਹਰ ਚਲੀਏ ਉਹ ਫਟ ਕੇ ਗੇਟ ਵੱਲ ਚਲਿਆ ਜਾਂਦਾ ਹੈ ਸੱਚ ਮੁੱਚ ਕੁੱਤੇ ਵੀ ਬਹੁਤ ਸਮਝਦੇ ਹਨ ਇੱਕ ਹੋਰ ਮਜ਼ੇਦਾਰ ਚੁਟਕਲਾ ਇੱਕ ਮਾਸਟਰ ਜੀ ਪਿੰਡ ਦੇ ਬੱਚਿਆ ਨੂੰ ਸਿਖਾ ਰਹੇ ਹਨ ਉਹ ਕਹਿੰਦੇ ਜੇ ਤੁਸੀਂ ਇੱਕ ਬੱਦਲ 'ਤੇ ਚੜ੍ਹੇ ਹੋ ਤਾਂ ਕੀ ਕਰੋਗੇ ਇੱਕ ਬੱਚਾ ਕਹਿੰਦਾ ਮਾਸਟਰ ਜੀ ਮੈਂ ਪਹਿਲਾਂ ਹੀ ਇਨਕਾਰ ਕਰ ਦੇਵਾਂਗਾ ਸਭ ਬੱਚੇ ਹੱਸ ਪਏ ਕਿਉਂਕਿ ਉਹ ਜਾਣਦੇ ਸਨ ਕਿ ਬੱਦਲ 'ਤੇ ਚੜ੍ਹਨਾ ਕੋਈ ਆਸਾਨ ਗੱਲ ਨਹੀਂ ਇਹ ਦੋ ਚੁਟਕਲੇ ਬਹੁਤ ਮਜ਼ੇਦਾਰ ਅਤੇ ਜਦੋਂ ਵੀ ਮੇਰੇ ਮਨ ਵਿੱਚ ਆਉਂਦੇ ਹਨ ਮੈਂ ਬਹੁਤ ਹੱਸਦਾ ਹਾਂ